ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਬਹੁਤ ਹਿਸਟੋਰੀਕਲ ਪਲੇਸਿਸ ਨੇ ਜਿਵੇਂ ਗੋਲਡਨ ਟੈਂਪਲ ਬਣਿਆ ਅੰਮ੍ਰਿਤਸਰ ਉੱਥੇ ਤੁਸੀਂ ਆ ਸਕਦੇ ਗੋਲਡਨ ਟੈਂਪਲ ਜਿੱਦਾਂ ਗੁਰੂ ਅਰਜਨ ਦੇਵ ਜੀ ਨੇ ਸੰਤ ਮੀਆਂ ਮੀਰ ਜੀ ਤੋਂ ਨੀਂਹ ਪੱਥਰ ਰਖਵਾਇਆ ਸੀਗਾ ਹਾਂਜੀ ਅਤੇ ਉਹ ਤੋਂ ਬਾਅਦ ਉਹਦੇ ਨਾਲ ਹੀ ਜਲਿਆਂਵਾਲਾ ਬਾਗ ਹੈ ਉੱਥੇ ਬਣੇ ਹੋਏ ਨੇ ਬੜੇ ਵਧੀਆ ਅੰਦਰ ਦੇਖਣ ਵਾਲੀ ਚੀਜ਼ ਹੈ ਅਤੇ ਬਾਘਾ ਬੋਡਰ ਉਹਦੇ ਕੋਲ ਹੀ ਹਾਂਜੀ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਅਤੇ ਉਹ ਤੋਂ ਬਾਅਦ ਅਨੰਦਪੁਰ ਸਾਹਿਬ ਆਪਣਾ ਕੇਸਗੜ੍ਹ ਹੈ ਤਖ਼ਤ ਅਕਾਲ ਸ਼੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਵੀ ਤੁਸੀਂ ਮੱਥਾ ਟੇਕ ਸਕਦੇ ਹੋ ਨਤਮਸਤਕ ਹੋ ਸਕਦੇ ਹੋ ਉੱਥੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ ਜਿੱਥੋਂ ਖਾਲਸਾ ਪੰਥ ਸਟਾਰਟ ਹੋਇਆ ਸੀ ਤੇਰ੍ਹਾਂ ਅਪ੍ਰੈਲ ਸੌਲ੍ਹਾਂ ਸੌ ਨੜਿਨਵੇਂ ਈਸਵੀ ਨੂੰ ਕਰਿਆ ਸੀ ਉਹਨਾਂ ਨੇ ਅਤੇ ਉਹ ਤੋਂ ਬਾਅਦ ਉੱਥੇ ਵਿਰਾਸਤ ਏ ਖਾਲਸਾ ਬਣਿਆ ਹੋਇਆ ਦੇਖਣ ਵਾਲੀ ਚੀਜ਼ ਆ ਬੜੀ ਵਧੀਆ ਅਤੇ ਨੈਕਸਟ ਆਪਾਂ ਫਤਿਹਗੜ੍ਹ ਸਾਹਿਬ ਆ ਜਿੱਥੇ ਸ਼ਹੀਦਾਂ ਦੀ ਧਰਤੀ ਮੰਨੀ ਜਾਂਦੀ ਆ ਉੱਥੇ ਹਾਂਜੀ ਹਾਂਜੀ ਜਿੱਦਾਂ ਫਤਿਹਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕੀਤੇ ਗਏ ਮੁਗਲਾਂ ਦੁਆਰਾ ਅਤੇ ਮਾਤਾ ਗੁਜਰ ਕੌਰ ਜੀ ਵੀ ਸ਼ਹੀਦ ਹੋਏ ਇੱਥੇ ਹੋਰ ਵੀ ਬਹੁਤ ਪਲੇਸਿਸ ਨੇ ਜਿੱਦਾਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਆਮ ਖਾਸ ਬਾਗ ਹੈ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਜਿੱਥੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਇੱਦਾਂ ਹੋਰ ਵੀ ਬਹੁਤ ਪਲੇਸਿਸ ਨੇ ਅਤੇ ਆਇਓ ਤੁਸੀਂ ਜ਼ਰੂਰ ਅਤੇ ਦੁਬਾਰਾ ਕੋਲ ਕਰ ਲਿਓ ਜੇ ਕੋਈ ਪ੍ਰੋਬਲਮ ਹੋਈ ਠੀਕ ਹੈ ਜੀ ਓਕੇ